ਮੈਂ ਬਚਪਨ ਤੋਂ ਹੀ ਵਿਗਿਆਨ ਪ੍ਰਤੀ ਬਹੁਤ ਹੀ ਰੁਚਿਤ ਰਹਿੰਦਾ ਸੀ ਸਕੂਲ ਵਿੱਚ ਮੇਰਾ ਸਭ ਤੋਂ ਮਨਪਸੰਦ ਵਿਸ਼ਾ ਵਿਗਿਆਨ ਸੀ ਮੈਨੂੰ ਚੀਜ਼ਾਂ ਕਿਵੇਂ ਕੰਮ ਕਰਦੀਆਂ ਹਨ ਕੁਦਰਤ ਕਿਵੇਂ ਕੰਮ ਕਰਦੀ ਹੈ ਅਤੇ ਇਨਸਾਨ ਨਵੀਆਂ ਚੀਜ਼ਾਂ ਦੀ ਖੋਜ ਕਿਵੇਂ ਕਰਦੇ ਹਨ ਇਸ ਬਾਰੇ ਸਿੱਖਣ ਦਾ ਬਹੁਤ ਆਨੰਦ ਮਿਲਦਾ ਸੀ ਸਕੂਲ ਵਿੱਚ ਵਿਗਿਆਨ ਮੇਰਾ ਮਨਪਸੰਦ ਵਿਸ਼ਾ ਸੀ ਅਤੇ ਮੈਂ ਹਮੇਸ਼ਾ ਹੀ ਪ੍ਰਯੋਗਸ਼ਾਲਾ ਵਿੱਚ ਕੀਤੇ ਗਏ ਪ੍ਰਯੋਗਾਂ ਅਤੇ ਪ੍ਰੋਜੈਕਟਾਂ ਦੀ ਉਡੀਕ ਕਰਦਾ ਸੀ ਮੈਨੂੰ ਇੱਕ ਅਸਲੀ ਵਿਗਿਆਨੀ ਵਾਂਗੂ ਮਹਿਸੂਸ ਹੁੰਦਾ ਸੀ ਦੂਜੇ ਪਾਸੇ ਗਣਿਤ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਦਾ ਸੀ ਮੇਰਾ ਸਭ ਤੋਂ ਔਖਾ ਵਿਸ਼ਾ ਮੈਨੂੰ ਗਣਿਤ ਲੱਗਦਾ ਸੀ ਮੈਨੂੰ ਫਾਰਮੂਲਿਆਂ ਨੂੰ ਸਮਝਣਾ ਬਹੁਤ ਮੁਸ਼ਕਲ ਲੱਗਿਆ ਅਤੇ ਮੈਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸੰਘਰਸ਼ ਕੀਤਾ ਮੈਨੂੰ ਗਣਿਤ ਦੇ ਟੈਸਟਾਂ ਅਤੇ ਹੋਰ ਹੋਮਵਰਕ ਤੋਂ ਵੀ ਨਫਰਤ ਸੀ ਮੈਂ ਅਕਸਰ ਨਿਰਾਸ਼ ਨਿਰਾਸ਼ ਮਹਿਸੂਸ ਕਰਦਾ ਸੀ ਗਣਿਤ ਦਾ ਮੇਰੇ ਕੋਲ ਕੋਈ ਅਰਥ ਨਹੀਂ ਸੀ ਅਤੇ ਮੈਂ ਚਾਹੁੰਦਾ ਸੀ ਕਿ ਇਹ ਪੂਰੀ ਤਰ੍ਹਾਂ ਬਚ ਸਕਾਂ ਇਸ ਤੋਂ ਮੇਰੇ ਸਕੂਲ ਜੀਵਨ ਦੀ ਸਭ ਤੋਂ ਯਾਦਗਾਰ ਪਲਾਂ ਵਿੱਚੋਂ ਇੱਕ ਪਲ ਮੇਰੀ ਫੇਅਰਵੈੱਲ ਪਾਰਟੀ ਸੀ ਜਿਹਨੂੰ ਵਿਦਾਇਗੀ ਪਾਰਟੀ ਵੀ ਕਿਹਾ ਜਾਂਦਾ ਹੈ ਜੋ ਕਿ ਮੈਨੂੰ ਮੇਰੇ ਆਖਰੀ ਸਾਲ 'ਚ ਮਿਲੀ ਸੀ ਇਹ ਇੱਕ ਕੌੜਾ ਮਿੱਠਾ ਮੌਕਾ ਸੀ ਕਿਉਂਕਿ ਇਸ ਵਿੱਚ ਆਪਣਿਆਂ ਆਪਣਿਆਂ ਪ੍ਰਤੀ ਪ੍ਰਾਪਤੀਆਂ ਅਤੇ ਦੋਸਤਾਂ ਦੇ ਜਸ਼ਨ ਮਨਾਉਂਦੇ ਹਾਂ ਪਰ ਆਪਣੇ ਵਿਧਿਅਕ ਅਧਿਆਪਕਾਂ ਅਤੇ ਸਹਿਪਾਠੀਆਂ ਨੂੰ ਅਲਵਿਦਾ ਕਹਿਣਾ ਪੈਂਦਾ ਹੈ ਇਸ ਵਿੱਚ ਸਾਨੂੰ ਨੱਚਣ ਗਾਉਣ ਖੇਡਾਂ ਖੇਡਣ ਅਤੇ ਕਹਾਣੀਆਂ ਸਾਂਝੀ ਕਰਨ ਦਾ ਬਹੁਤ ਮਜ਼ਾ ਆਇਆ ਸਾਨੂੰ ਸਾਡੇ ਅਕਾਦਮਿਕ ਅਤੇ ਪਾਠਕ੍ਰਮ ਤੋਂ ਬਾਹਰਲੇ ਪ੍ਰਦਰਸ਼ਨ ਲਈ ਪੁਰਸਕਾਰ ਅਤੇ ਸਰਟੀਫਿਕੇਟ ਵੀ ਮਿਲੇ